ਸੱਤ ਸੌ ਛਿਆਸੀ ਪੰਜ ਲੱਖ ਸਤਾਸੀ ਹਜ਼ਾਰ ਨੌ ਸੌ ਬਿਆਲੀ ਤੀਹ ਹਜ਼ਾਰ ਸੱਤ ਸੌ ਇਕੱਨਵੇ ਨੌ ਲੱਖ ਨੜਿੱਨਵੇ ਹਜ਼ਾਰ ਸੱਤ ਸੌ ਇਕਿਆਸੀ ਅੱਠ ਲੱਖ ਛਿਆਸੀ ਹਜ਼ਾਰ ਤਿੰਨ ਸੌ